ਸਤਿ ਸ਼੍ਰੀ ਅਕਾਲ ਮੈਮ ਮੈਡਮ ਮੇਰਾ ਨਾਮ ਆਰੂਸ਼ੀ ਸ਼ਰਮਾ ਹੈ ਅਤੇ ਮੈਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਬੀਲੋਂਗ ਕਰਦੀ ਹਾਂ ਅਤੇ ਮੈਂ ਤੁਹਾਡੇ ਅੱਗੇ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਮੈਂ ਅਜੇ ਤੱਕ ਗੁਰਦਾਸਪੁਰ ਸ਼ਹਿਰ ਜਿਹੜਾ ਹੈ ਉਹ ਨਹੀਂ ਵੇਖਿਆ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਕਿਹੜੀਆਂ ਕਿਹੜੀਆਂ ਕੋਈ ਖਾਸ ਜਗ੍ਹਾ ਨੇ ਜਿੱਥੋਂ ਅਸੀਂ ਘੁੰਮਣ ਜਾ ਸਕਦੇ ਹਾਂ ਜਿੱਥੋਂ ਸਾਨੂੰ ਕੁਛ ਸਿੱਖਣ ਨੂੰ ਮਿਲ ਸਕਦਾ ਹਾਂਜੀ ਮੈਡਮ ਮੈਂ ਇਤਿਹਾਸਿਕ ਜਗ੍ਹਾ 'ਤੇ ਜਾ ਕੇ ਉਸ ਚੀਜ਼ ਬਾਰੇ ਜਾਣਨਾ ਚਾਹੁੰਦੀ ਹਾਂ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਠੀਕ ਹੈ ਠੀਕ ਹੈ ਠੀਕ ਹੈ ਮੈਡਮ ਠੀਕ ਹੈ ਮੈਡਮ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਜਦੋਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਵਾਂਗੀ ਤਾਂ ਮੈਂ ਤੁਹਾਨੂੰ ਜ਼ਰੂਰ ਮਿਲਾਂਗੀ ਅਤੇ ਤੁਸੀਂ ਮੈਂ ਉਮੀਦ ਕਰਾਂਗੀ ਕਿ ਤੁਸੀਂ ਮੈਨੂੰ ਇਹਨਾਂ ਸਾਰੀਆਂ ਜਗ੍ਹਾ ਦੇ ਬਾਰੇ ਚੰਗੀ ਤਰ੍ਹਾਂ ਦੱਸ ਸਕੋਗੇ ਠੀਕ ਹੈ ਠੀਕ ਹੈ ਧੰਨਵਾਦ ਮੈਮ